ਸਾਡੇ ਦੇਸ਼ ਭਾਰਤ 'ਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਜਿਵੇਂ ਕਿ ਕਬੱਡੀ ਖੋ ਖੋ ਬੈਡਮਿੰਟਨ ਕ੍ਰਿਕਟ ਹਾਕੀ ਤੈਰਾਕੀ ਦੌੜਾਂ ਆਦਿ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਹਾਕੀ ਭਾਰਤ ਦੀ ਨੈਸ਼ਨਲ ਗੇਮ ਹੈ ਸਾਡੇ ਦੇਸ਼ 'ਚ ਮਸ਼ਹੂਰ ਐਥਲੀਟਸ ਹਨ ਵਿਰਾਟ ਕੋਹਲੀ ਸੁਨੀਲ ਗਾਵਸਕਰ ਸਾਨੀਆ ਮਿਰਜ਼ਾ ਪੀ ਟੀ ਊਸ਼ਾ ਸਾਨੀਆ ਨੇਹਵਾਲ ਮਿਤਾਲੀ ਰਾਜ ਮਿਲਖਾ ਸਿੰਘ ਐੱਮ ਐੱਸ ਧੋਨੀ ਸੁਨੀਲ ਛੇਤਰੀ ਕਪਿਲ ਦੇਵ